ਤੇਈ ਫਰਵਰੀ ਉੱਨੀ ਸੌ ਅਠਾਨਵੇਂ ਬਾਰ੍ਹਾਂ ਅਪ੍ਰੈਲ ਦੋ ਹਜ਼ਾਰ ਪੰਜ ਪੱਚੀ ਅਗਸਤ ਦੋ ਹਜ਼ਾਰ ਤੇਈ ਸੋਲ੍ਹਾਂ ਜਨਵਰੀ ਉੱਨੀ ਸੌ ਨੜਿਨਵੇਂ ਪੰਦਰ੍ਹਾਂ ਅਪ੍ਰੈਲ ਉੱਨੀ ਸੌ ਨੜਿਨਵੇਂ